ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਸਵੀਗੀ ਕਸਟਮਰ ਕੇਅਰ ਤੋਂ ਬੋਲ ਰਹੇ ਓਂ ਮੈਂ ਤੁਹਾਡੇ ਕੋਲੋਂ ਕੁਝ ਅ ਔਡਰ ਕੀਤਾ ਸੀ ਦੋ ਘੰਟੇ ਪਹਿਲਾਂ ਔਡਰ ਨੰਬਰ ਦਸ ਸੀ ਜਿਸਦੇ ਵਿੱਚ ਦਾਲ ਰੋਟੀ ਚਾਵਲ ਸਬਜ਼ੀ ਅਤੇ ਕੁਝ ਸਵੀਟਸ ਵੀ ਸੀ ਉ ਉਹ ਮੈਨੂੰ ਅਜੇ ਤੱਕ ਨਹੀਂ ਮਿਲਿਆ ਪਰ ਜੋ ਮੇਰੇ ਜੋ ਤੁਸੀਂ ਡਿਲੀਵਰ ਕੀਤਾ ਉਹਦੇ ਤੋਂ ਸ਼ੋਅ ਹੋ ਰਿਹਾ ਪਰ ਜੀ ਪੀ ਐੱਸ 'ਤੇ ਵੀ ਸ਼ੋਅ ਹੋ ਰਿਹਾ ਕਿ ਬੰਦਾ ਇਸ ਥਾਂ 'ਤੇ ਪਹੁੰਚ ਚੁੱਕਿਆ ਹੈ ਪਰ ਮੇਰੇ ਕੋਲ ਨਹੀਂ ਪਹੁੰਚਿਆ ਮੇਰੇ ਘਰ ਦਾ ਪਤਾ ਕੁਲਾਰ ਮਹੱਲਾ ਜੀਰੋ ਪੰਜ ਹੈ ਅ ਹੈ ਅਤੇ ਇੱਥੇ ਉਹ ਨਹੀਂ ਪਹੁੰਚਿਆ ਇਸ ਇਹਤੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਜਾਂ ਤਾਂ ਤੁਸੀਂ ਉਸ ਉਹਦੇ ਨਾਲ ਕੋਈ ਕੰਟੈਕਟ ਕਰਕੇ ਮੈਨੂੰ ਦੱਸ ਦਿਓ ਜਾਂ ਫਿਰ ਮੇਰੇ ਪੈਸੇ ਮੈਨੂੰ ਵਾਪਸ ਕਰ ਦਿਓ ਜਾਂ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਹੱਲ ਕਰ ਦਿਓ ਤਾਂ ਕਿ ਜਿਹੜੀ ਡਿਲੀਵਰੀ ਹੈ ਉਹ ਮੇਰੇ ਕੋਲ ਪਹੁੰਚ ਜਾਵੇ ਅਤੇ ਮੇਰੇ ਘਰ 'ਚ ਬਹੁਤ ਸਾਰੇ ਮਹਿਮਾਨ ਆਏ ਹੈ ਅਤੇ ਮੈਂ ਉਹਨਾਂ ਨੂੰ ਖਾਣਾ ਦੇਣਾ ਏ ਇਸ ਕਰਕੇ ਥੋੜ੍ਹੀ ਹੈਲਪ ਕੀਤੀ ਮਦਦ ਕੀਤੀ ਜਾਵੇ